ਅੱਜ ਦੇ ਸਮਿਆਂ ਵਿੱਚ ਸਾਡੇ ਇਲਾਕੇ ਵਿੱਚ ਬਾਲ ਮਜ਼ਦੂਰੀ ਬਹੁਤ ਘੱਟ ਹੈ ਕਿਉਂਕਿ ਸਮੇਂ ਸਮੇਂ ਉੱਤੇ ਪ੍ਰਸ਼ਾਸਨ ਵੱਲੋਂ ਬਾਲ ਮਜ਼ਦੂਰੀ ਉੱਤੇ ਸੈਮੀਨਾਰ ਲਾਏ ਜਾਂਦੇ ਹਨ ਤਾਂ ਜੋ ਇਹਨਾਂ ਮੁੱਦਿਆਂ ਨੂੰ ਘੱਟ ਕੀਤਾ ਜਾ ਸਕੇ ਬਾਲ ਮਜ਼ਦੂਰੀ ਨੂੰ ਸੈਮੀਨਾਰ ਲਾ ਕੇ ਬੱਚਿਆਂ ਨੂੰ ਸਿੱਖਿਆ ਦੇ ਕੇ ਅਤੇ ਇਹਨਾਂ ਤੋਂ ਬਚਾਇਆ ਜਾ ਸਕਦਾ ਏ ਬੱਚੇ ਅੱਜ ਕੱਲ੍ਹ ਟੈਕਨੋਲਜੀ ਦੇ ਖੇਤਰ ਵਿੱਚ ਜ਼ਿਆਦਾ ਰੁਝਾਨ ਰੱਖਦੇ ਹਨ ਇਸ ਵਿੱਚ ਰੁਜ਼ਗਾਰ ਵੀ ਬਹੁਤ ਸਾਧਨ ਹਨ ਹੋਰ ਵੀ ਛੋਟੇ ਕਿੱਤੇ ਹਨ ਜਿਹਨਾਂ ਵਿੱਚ ਬੱਚੇ ਰੁਚੀ ਰੱਖਦੇ ਹਨ ਪ੍ਰਸ਼ਾਸਨ ਨੂੰ ਇਹਨਾਂ ਕਿੱਤਿਆਂ ਦੀ ਸਿਖਲਾਈ ਲਈ ਕੇਂਦਰ ਹੋਰ ਖੋਲ੍ਹਣੇ ਚਾਹੀਦੇ ਹਨ ਤਾਂ ਜੋ ਹਰ ਬੱਚਾ ਸਿੱਖ ਸਕੇ ਅਤੇ ਬਾਲ ਮਜ਼ਦੂਰੀ ਤੋਂ ਬਚ ਸਕੇ